ਭੰਗੜਾ ਇੱਕ ਪੰਜਾਬ ਦਾ ਨਾਚ ਹੀ ਨਹੀਂ ਇੱਕ ਵਧੀਆ ਕਸਰਤ ਹੈ ਭੰਗੜਾ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਖੁਸ਼ ਰੱਖਦਾ ਹੈ ਭੰਗੜਾ ਸਰੀਰ ਨੂੰ ਚੁਸਤ ਫੁਰਤ ਫੁਰਤੀਲਾ ਰੱਖਦਾ ਹੈ ਭੰਗੜਾ ਪਾਨ ਵਾਲੇ ਦਾ ਸ਼ਰੀਰ ਦਾ ਅੰਗ ਅੰਗ ਹਿੱਲਦਾ ਹੈ ਜਿਸ ਨਾਲ ਸਾਰੇ ਸਰੀਰ ਵਿੱਚ ਖੂਨ ਦਾ ਦੌਰਾ ਪ੍ਰੋਪਰ ਹੁੰਦਾ ਹੈ ਨਾ ਤਾਂ ਸਾਨੂੰ ਕਦੇ ਜੋੜਾਂ ਦੀ ਪ੍ਰੋਬਲਮ ਆਉਂਦੀ ਹੈ ਨਾ ਹੀ ਕਿਸੇ ਤਰੀਕੇ ਦੀ ਬਲੋਕੇਜ ਆ ਸਕਦੀ ਹੈ ਸਾਡੀ ਦਿਮਾਗੀ ਹਾਲਤ ਨੂੰ ਵੀ ਤੰਦਰੁਸਤ ਰੱਖਦਾ ਹੈ ਭੰਗੜਾ ਖੁਸ਼ੀ ਦੀ ਨਿਸ਼ਾਨੀ ਹੈ ਭੰਗੜਾ ਪਾਉਣ ਨਾਲ ਸਾਰੀਆਂ ਚਿੰਤਾਵਾਂ ਨੂੰ ਇੱਕ ਵਾਰ ਬੰਦਾ ਭੁੱਲ ਜਾਂਦਾ ਹੈ ਭੰਗੜਾ ਪਾਉਣ ਨਾਲ ਇਨਸਾਨ ਕਦੇ ਵੀ ਬਿਮਾਰ ਨਹੀਂ ਹੋ ਸਕਦਾ ਹੈ